ਭਾਰਤੀ ਰਾਜਨੀਤੀ ਅਤੇ ਸਿਆਸੀ ਪਾਰਟੀਆਂ ਬਾਰੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਜਦੋਂ ਇਹਨਾਂ ਨੂੰ ਕੰਮ ਹੁੰਦਾ ਜਨਤਾ ਤੱਕ ਜਿੱਦਾਂ ਇਲੈਕਸ਼ਨ ਆਉਂਦੀ ਹੈ ਉਸ ਤੋਂ ਪਹਿਲਾਂ ਇਹ ਅੱਛੇ ਅੱਛੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਐ ਕਿ ਸ ਅਸੀਂ ਲੋਕਾਂ ਦੀਆਂ ਇੱਕ ਵਾਰ ਨਜ਼ਰਾਂ 'ਚ ਆ ਜਾਈਏ ਵੀ ਹਾਂ ਇਸ ਪਾਰਟੀ ਨੇ ਇਹ ਕੰਮ ਕੀਤਾ ਜਦੋਂ ਵੋਟਾਂ ਹੁੰਦੀਆਂ ਇਹ ਘਰ ਘਰ ਜਾਂਦੇ ਐ ਲੋਕਾਂ ਨੂੰ ਆਪਣੇ ਅਕੋਡਿੰਗਲੀ ਮੋਟੀਵੇਟ ਕਰਦੇ ਐ ਕਿ ਸਾਨੂੰ ਤੁਸੀਂ ਵੋਟ ਪਾਓ ਲੋਕ ਵੀ ਉਸ ਟਾਈਮ ਇਹਨਾਂ ਦੇ ਦਿਲਾਸੇ 'ਚ ਆ ਕੇ ਉਹਨਾਂ ਨੂੰ ਵੋਟ ਪਾ ਦਿੰਦੇ ਐ ਈਵਨ ਜਿਹੜੇ ਪੜ੍ਹੇ ਲਿਖੇ ਲੋਕ ਆ ਉਹ ਵੀ ਇਹਨਾਂ ਦੀ ਗੱਲਾਂ 'ਚ ਆ ਜਾਂਦੇ ਕਿ ਨਹੀਂ ਇਹਦੇ ਵਰਗਾ ਬੰਦਾ ਕੋਈ ਨਹੀਂ ਹੈ ਜਦੋਂ ਵੋਟ ਵੋਟਾਂ ਤੋਂ ਬਾਅਦ ਇਹ ਜਿੱਤ ਜਾਂਦੇ ਆ ਉਸ ਤੋਂ ਬਾਅਦ ਇਹ ਭੁੱਲ ਜਾਂਦੇ ਆ ਕਿ ਹਾਂ ਅਸੀਂ ਕਿਹੜੇ ਕਿਹੜੇ ਵਾਅਦੇ ਕੀਤੇ ਸੀਗੇ ਕੀ ਅਸੀਂ ਲੋਕਾਂ ਨੂੰ ਕਿਹਾ ਸੀ ਭਾਰਤ ਦੇ ਲੋਕਤੰਤਰ ਵਜੋਂ ਜਿਹੜੀ ਚੀਜ਼ ਸਾਨੂੰ ਪਸੰਦ ਹੈ ਉਹ ਇਹ ਹੈ ਕਿ ਸਾਨੂੰ ਅੱਜ ਵੀ ਵੋਟ ਪਾਉਣ ਦਾ ਅਧਿਕਾਰ ਹੈ ਅਸੀਂ ਬਿਨਾਂ ਕਿਸੇ ਦੇ ਫੋਰਸ ਤੋਂ ਆਪਣੀ ਵੋਟ ਖੁਦ ਪਾ ਸਕਦੇ ਹਾਂ ਸਾਨੂੰ ਕੋਈ ਫੋਰਸ ਨਹੀਂ ਕਰ ਸਕਦਾ ਕਿ ਹਾਂਜੀ ਤੁਸੀਂ ਸਾਨੂੰ ਵੋਟ ਪਾਓ ਨਾ ਪਸੰਦ ਇਹ ਗੱਲ ਹੈ ਕਿ ਜੇ ਭੀੜ ਵਿੱਚੋਂ ਸੌ ਦੀ ਭੀੜ ਵਿੱਚੋਂ ਸੱਤਰ ਆਦਮੀ ਬੰਦੇ ਮੂਰਖ ਹੈ ਤੀਹ ਇੰਟੈਲੀਜੈਂਟ ਹੈ ਤਾਂ ਉਹ ਤੀਹ ਜਿਹੜੇ ਇੰਟੈਲੀਜੈਂਟ ਹੈ ਉਹਨਾਂ ਦੀ ਗੱਲ ਨਹੀਂ ਸੁਣਨਗੇ ਜਿਹੜੇ ਸੱਤਰ ਮੂਰਖ ਹੈ ਉਹਨਾਂ ਦੀ ਗੱਲ ਸੁਣਨਗੇ ਮਤਲਬ ਲੋਕਤੰਤਰ ਵਿੱਚ ਅਕੁਆਲਿਟੀ ਦੀ ਕੋਈ ਵੈਲਿਊ ਨਹੀਂ ਹੈ ਕੁਆਂਟਿਟੀ ਦੀ ਵੈਲਿਊ ਹੈ ਕਿ ਹਾਂ ਜਿਹੜੇ ਸੱਤਰ ਹੈ ਉਹ ਜ਼ਿਆਦਾ ਹੈ ਆਪਾਂ ਉਹਦੀ ਸੁਣਨੀ ਹੈ ਜਿਹੜੇ ਤੀਹ ਇੰਟੈਲੀਜਟ ਬੰਦੇ ਹੈ ਉਹਨਾਂ ਦੀ ਨਹੀਂ ਆਪਾਂ ਸੁਣਨੀ ਹੈਗੀ ਇ ਇਹਦੇ ਵਿੱਚ ਅਸੀਂ ਅਗਰ ਗਰ ਅ ਰਾਜਨੀਤਿਕ ਨੇਤਾ ਹੈ ਜਿਹੜੇ ਮਨਪਸੰਦ ਕਹਿ ਲਈਏ ਜਾਂ ਜਿਹੜੀ ਵੀ ਪੋਲੀਟੀਕਲ ਪਾਰਟੀਜ਼ ਵਿੱਚ ਨੇਤਾ ਹੈ ਜੇ ਸਾਨੂੰ ਮਿਲਦੇ ਹੈ ਤਾਂ ਅਸੀਂ ਉਹਨਾਂ ਤੋਂ ਇਹ ਪੁੱਛਾਂਗੇ ਕਿ ਜਦੋਂ ਉੱਨੀ ਸੌ ਇਕਾਨਵੇਂ ਬਾਨਵੇਂ ਵਿੱਚ ਸੰਕਟ ਆਇਆ ਸੀਗਾ ਤਾਂ ਉਹਨਾਂ ਨੇ ਉਸ ਟਾਈਮ ਕਿਆ ਡਿਸੀਜ਼ਨ ਲਏ ਸੀਗੇ ਉਹਨਾਂ ਦੀ ਉਹਨਾਂ ਦੀ ਡਿਸੀਜ਼ਨ ਮੇਕਿੰਗ ਪਾਵਰ ਕੀ ਸੀ ਕੀ ਲੱਗਿਆ ਉਹਨਾਂ ਨੂੰ ਕਿਉਂਕਿ ਉਹ ਉਸ ਟਾਈਮ ਗਵਰਮੈਂਟ ਨੂੰ ਦੇਖ ਰਹੇ ਸੀਗੇ ਉਹਨਾਂ ਦੇ ਕਿਆ ਵਿਊਜ਼ ਸੀਗੇ ਕਿੱਦਾਂ ਉਹਨਾਂ ਨੇ ਉਹ ਸਾਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ